ਹੈਲੋ ਸਤਿ ਸ਼੍ਰੀ ਅਕਾਲ ਮੈਮ ਮੈਮ ਮੈਂ ਨਾ ਇੱਥੇ ਨਿਊ ਆਈ ਹਾਂ ਅਤੇ ਮੈਂ ਨਾ ਤਰਨ ਤਾਰਨ ਦਾ ਇੱਕ ਦਿਨ ਲਈ ਟ੍ਰਿਪ ਸੋਚਦੀ ਪਈ ਸੀਗੀ ਅਤੇ ਮੈਂ ਮਤਲਬ ਕਿ ਤੁਹਾਡੇ ਤੋਂ ਮਤਲਬ ਪੁੱਛਣਾ ਸੀਗਾ ਕਿ ਤਰਨ ਤਾਰਨ ਵਿੱਚ ਜਾਂ ਸ਼ੋਪਿੰਗ ਕਰਨੀ ਹੋਵੇ ਜਾਂ ਘੁੰਮਣ ਫਿਰਨ ਲਈ ਕਿਹੜੀ ਜ ਜਗ੍ਹਾ ਵਧੀਆ ਰਹੂਗੀ ਹਾਂਜੀ ਅੱਛਾ ਹਾਂਜੀ ਹਾਂਜੀ ਠੀਕ ਹੈ ਹਾਂਜੀ ਮੈਮ ਖਾਣ ਪੀਣ ਲਈ ਮਤਲਬ ਕਿਹੜੀ ਜਗ੍ਹਾ ਵਧੀਆ ਰਹੁੰਗੀ ਹਾਂਜੀ ਓਕੇ ਓਕੇ ਮੈਮ ਇੱਥੇ ਅਗਰ ਮੈਂ ਆਉਣਾ ਹੋਵੇ ਤਾਂ ਮਤਲਬ ਕਿਹੜੇ ਵਹੀਕਲ 'ਤੇ ਸਹੀ ਰਹੂਗਾ ਕੰਫਰਟੇਬਲ ਰਹੂਗਾ ਇੱਥੇ ਬਾਜ਼ਾਰ ਦਾ ਕਿਸ ਤਰ੍ਹਾਂ ਸਿਸਟਮ ਆ ਹਾਂਜੀ ਅੱਛਾ ਅੱਛਾ ਠੀਕ ਹੈ ਫਿਰ ਹਾਂਜੀ ਓਕੇ ਥੈਂਕ ਯੂ ਮੈਮ